ਦੰਦਾਂ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਜੀ ਦੰਦਾਂ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਸਵੇਰੇ ਉੱਠ ਕੇ ਬਰੱਸ਼ ਕਰੋ ਦੰਦਾਂ ਨੂੰ ਸਾਫ਼ ਰਹਿਣਗੇ ਜਿੰਨੇ ਸਾਫ਼ ਰਹਿਣਗੇ ਓਨੇ ਜਾੜ੍ਹਾਂ ਮਜ਼ਬੂਤ ਦੰਦ ਮਜ਼ਬੂਤ ਰਹਿਣਗੇ ਜੀ ਠੀਕ ਹੈ ਜੀ ਰਾਤ ਨੂੰ ਆਪਾਂ ਖਾਣਾ ਖਾਣ ਤੋਂ ਬਾਅਦ ਦੰਦ ਸਾਫ਼ ਕ ਰੱਖੋ ਬਰੱਸ਼ ਕਰੋ ਸੌਣ ਤੋਂ ਪਹਿਲਾਂ ਪਹਿਲਾਂ ਬਰੱਸ਼ ਕਰਕੇ ਕੋਲਗੇਟ ਆਪਣਾ ਵਿਸ਼ ਵਧੀਆ ਕਰੋ ਜਿਨ ਨਾਲ਼ ਦੰਦ ਨਾ ਖਰਾਬ ਹੋਣ ਦੰਦ ਹੈ ਤੇ ਸਭ ਕੁਛ ਠੀਕ ਹੈ ਜੀ ਦੰਦਾਂ ਨਾਲ਼ ਹੀ ਸਾਡਾ ਆਪਣਾ ਖਾਣ ਪੀਣ ਦਾ ਪ੍ਰਤੀ ਸਭ ਕੁਛ ਈ ਦੰਦਾਂ ਰਾਹੀਂ ਜਾਏਗਾ ਹੋਰ ਕੁਝ ਨੀ ਹੋ ਸਕਦਾ ਜੇ ਦੰਦ ਠੀਕ ਰਹਿਣਗੇ ਤਾਂ ਆਪਾਂ ਖਾ ਪੀ ਸਕਦੇ ਸਭ ਕੁਛ ਜਾੜ੍ਹਾਂ ਮਜ਼ਬੂਤ ਨੇ ਸਭ ਮਜ਼ਬੂਤ ਹੈ ਜੀ ਅਤੇ ਆਪਣਾ ਸਭ ਠੀਕ ਰਹੇਗਾ ਜੀ ਉਹਦੇ ਨਾਲ਼ ਦੰਦ ਸਾਫ਼ ਰੱਖਣੇ ਚਾਈਦੇ ਹੈ ਜੀ ਦੰਦਾਂ ਨੂੰ ਬਿਲਕੁਲ ਸਾਫ਼ ਰੱਖੋ ਜਿੰਨਾ ਸਾਫ਼ ਰੱਖੋਗੇ ਓਨੇ ਠੀਕ ਰਹਿਣਗੇ